ਸਤਾਰਾਂ ਨਵੰਬਰ ਉੱਨੀ ਸੌ ਛਿਆਨਵੇਂ ਸੌਲਾਂ ਫਰਵਰੀ ਉੱਨੀ ਸੌ ਸਤੰਨਵੇਂ ਤੇਈ ਨਵੰਬਰ ਉੱਨੀ ਸੌ ਅਠਾਨਵੇਂ ਚੌਦਾਂ ਨਵੰਬਰ ਉੱਨੀ ਸੌ ਛੱਬੀ ਤੇਈ ਨਵੰਬਰ ਦੋ ਹਜ਼ਾਰ ਤੇਈ